ਮੈਂ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਬਹੁਤ ਵਾਰੀ ਗਿਆ ਹਾਂ ਉਸ ਦਾ ਇਤਿਹਾਸ ਕੁਝ ਇਸ ਪ੍ਰਕਾਰ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਸੌਲਾਂ ਸੌ ਨੜਿਨਵੇਂ ਵਿੱਚ ਵਿਸਾਖੀ ਦੇ ਦਿਨ ਕੀਤੀ ਇਹ ਸਥਾਪਨਾ ਪੂਰੀ ਸਮਾਜੀਕ ਅਤੀਮਾਤਿਕ ਅਤੇ ਰਾਜਨੀਤੀ ਬਦਲਾਅ ਦੇ ਉਦੇਸ਼ ਨਾਲ ਕੀਤੀ ਗਈ ਖਾਲਸਾ ਦੇ ਮੁੱਖ ਉਦੇਸ਼ਾਂ ਵਿੱਚ ਸਿੰਚਾਈ ਨਿਆ ਅਤੇ ਧਰਮ ਦੀ ਸੁਰੱਖਿਆ ਕਰਨਾ ਜਿੱਥੇ ਵੀ ਬੁਰਾਈ ਹੋਵੇ ਉਸ ਦਾ ਖਿਲਾਫ ਲੜਨਾ ਤੇ ਗੁਰੂ ਨਾਨਕ ਦੇਵ ਵਿਰਸੇ ਨੂੰ ਅੱਗੇ ਵਧਾਉਣਾ ਸ਼ਾਮਿਲ ਸੀ ਗੁਰੂ ਜੀ ਨੇ ਖਾਲਸਾ ਨੂੰ ਸਾਦਿਆ ਦੇ ਰੂਪ ਵਿੱਚ ਮਸ਼ਹੂਰ ਕੀਤਾ ਜੋ ਮਾਂ ਤਾਂ ਮਾਨਵਤਾ ਦੀ ਸੇਵਾ ਤੇ ਬਦਲੀ ਦਾ ਪ੍ਰਤੀਕ ਬਣੇ ਇਹ ਸਿਰਫ ਧਰਮ ਨੂੰ ਨਹੀਂ ਸਗੋਂ ਇਹ ਇਕ ਸਮਾਜਿਕ ਅਤੇ ਰਾਸ਼ਟਰੀ ਪਹਿਚਾਣ ਵੀ ਸੀ ਜਿਸ ਨੇ ਸੰਗਤਾਂ ਅਤੇ ਸਰਦਾਰਾਂ ਨੇ ਇਕੱਠਾ ਕੀਤਾ ਅਤੇ ਮੁਸਲਮਾਨ ਹਿੰਦੂਆਂ ਦੇ ਦਰਮਿਆਨ ਭਾਈਚਾਰੇ ਨੂੰ ਸੁਰੱਖਿਅਤ ਕੀਤਾ